ਖੇਡਾਂ ਸਾਡੇ ਜੀਵਨ ਲਈ ਬੜਾ ਹੀ ਵਧੀਆ ਸਾਧਨ ਨੇ ਜਿਹੜੀਆਂ ਕਿ ਸਾਡੇ ਸਰੀਰ ਨੂੰ ਵੀ ਫਿੱਟ ਅਤੇ ਫਾਈਨ ਰੱਖਦੀਆਂ ਹਨ ਖੇਡਾਂ ਖੇਡਣ ਨਾਲ ਸਾਡਾ ਸਰੀਰ ਹੈ ਜਿਹੜਾ ਬੜਾ ਹੀ ਹੈਲਦੀ ਫੀਲ ਕਰਦਾ ਹੈ ਅਤੇ ਸਾਡੇ ਜਿਹੜੇ ਹੱਡ ਪੈਰ ਨੇ ਉਹ ਬੜੇ ਹੀ ਮਲ ਇਸ ਤਰੀਕੇ ਨਾਲ ਵਿਕਸਿਤ ਹੁੰਦੇ ਹਨ ਕਿ ਸਾਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਹੀਂ ਸਰੀਰ ਦੇ ਜੋ ਸਾਡੀ ਸਰੀਰ ਹੈ ਸਰੀਰਕ ਪ੍ਰੋਬਲਮ ਨੂੰ ਖਤਮ ਕਰਨ 'ਚ ਵੀ ਸਾਡੀਆਂ ਖੇਡਾਂ ਸਾਡੇ ਦਿਮਾਗ ਨੂੰ ਵਿਕਸਿਤ ਕਰਨ 'ਚ ਹਰ ਤਰ੍ਹਾਂ ਨਾਲ ਹਰ ਤਰੀਕੇ ਨਾਲ ਸਾਨੂੰ ਸਿਹਤਮੰਦ ਰੱਖਦੀਆਂ ਨੇ ਸਾਡੀਆਂ ਖੇਡਾਂ ਅਤੇ ਸਾਡਾ ਦਿਮਾਗ ਹੈ ਜਿਹੜਾ ਉਹ ਬੜਾ ਹੀ ਐਕਟਿਵ ਰਹਿੰਦਾ ਹੈ ਇਹ ਜਿਵੇਂ ਕਿ ਆਪਾਂ ਜੇ ਘਰ 'ਚ ਬੈਠੇ ਰਹੀਏ ਕੋਈ ਐਕਟੀਵਿਟੀ ਨਾ ਕਰੀਏ ਤਾਂ ਕਹਿੰਦੇ ਆ ਨਾ ਸਰੀਰ ਨੂੰ ਜੰਗ ਲੱਗ ਜਾਂਦੀ ਹੈ ਤਾਂ ਇੱਕ ਜਿਹੜੀਆਂ ਖੇਡਾਂ ਨੇ ਉਹ ਸਰੀਰ ਨੂੰ ਉਸ ਜੰਗ ਤੋਂ ਲੱਗਣ ਤੋਂ ਵੀ ਬਚਾਉਂਦੀਆਂ ਨੇ ਅਤੇ ਇੱਕ ਆਪਣੇ ਹੱਡਾਂ ਪੈਰਾਂ ਨੂੰ ਵੀ ਐਨਾ ਖੁੱਲ੍ਹਾ ਡੁੱਲਾ ਬਣਾਉਂਦੀਆਂ ਨੇ ਅਤੇ ਇੱਕ ਜਿਹੜੀ ਸਰੀ ਮ ਮਾਇੰਡ ਨੂੰ ਆਪਣੇ ਨੂੰ ਦਿਮਾਗ ਨੂੰ ਪੋਜੀਟਿਵਿਟੀ ਚਾਹੀਦੀ ਹੈ ਨਾ ਉਸ 'ਚ ਪੋਜੀਟਿਵਿਟੀ ਵੀ ਲਿਆਉਂਦੀਆਂ ਨੇ ਖੇਡਾਂ ਅਤੇ ਉਸ ਕਰਕੇ ਮਨੁੱਖ ਦੇ ਵਿਕਾਸ ਲਈ ਤਾਂ ਖੇਡਾਂ ਬਹੁਤ ਹੀ ਜ਼ਰੂਰੀ ਨੇ